ਮੈਂ ਸਕੂਲ ਦੇ ਵਿੱਚ ਛੇਵੀਂ ਕਲਾਸ ਤੋਂ ਜਿਹੜੀ ਪਹਿਲੀ ਵਾਰ ਪੇਂਟਿੰਗ ਸਿੱਖੀ ਸੀਗੀ ਸਕੂਲ ਦੇ ਵਿੱਚ ਜਦੋਂ ਸਾਨੂੰ ਪਹਿਲੀ ਵਾਰ ਪੇਂਟਿੰਗ ਸਿਖਾਈ ਗਈ ਸੀਗੀ ਤਾਂ ਸਾਨੂੰ ਸਟਾਰਟਿੰਗ ਸਾਡੀ ਪੈਨਸਲ ਨਾਲ ਪੇਂਟਿੰਗ ਬਣਾਉਣ ਦੀ ਹੋਈ ਸੀਗੀ ਤਾਂ ਮੈਂ ਘਰ ਆ ਕੇ ਵੀ ਮਤਲਬ ਆਪਦੇ ਘਰਦਿਆਂ ਤੋਂ ਇੱਕ ਡੋਰਾਇੰਗ ਨੋਟਬੁੱਕ ਮੰਗਵਾਈ ਜਿਹਦੇ ਵਿੱਚ ਅਸੀਂ ਪੈਨਸਨ ਨਾਲ ਜਿਹੜੀ ਪੇਂਟਿੰਗ ਬਣਾਉਂਦੇ ਸੀਗੇ ਅਤੇ ਉਸ ਤੋਂ ਬਾਅਦ ਮਤਲਬ ਕਲਰਜ਼ ਨਾਲ ਡਰਾਇੰਗ ਕਰਨ ਦਾ ਸਿੱਖਿਆ ਅਤੇ ਜਿਵੇਂ ਜਿਹੜੀ ਇੰਗਲਿਸ਼ ਦੇ ਇੱਕ ਸ਼ਬਦ ਹੁੰਦੇ ਐਗੇ ਵੱਡੇ ਅੱਖਰ ਹੁੰਦੇ ਐਗੇ ਕੈਪੀਟਲ ਤਾਂ ਉਹ ਜਿਹੜੇ ਮੈਂ ਸਭ ਤੋਂ ਪਹਿਲਾਂ ਮੈਨੂੰ ਮੈਂ ਉਹ ਸਿੱਖੇ ਅਤੇ ਉਹ ਅੱਜ ਵੀ ਮੈਂ ਲਗਾਤਾਰ ਉਹਨਾਂ ਨੂੰ ਜਿਹੜੇ ਕਲਰਜ਼ ਨਾਲ ਡਰੋਅ ਕਰਦੀ ਰਹਿੰਦੀ ਹਾਂ